ਭਾਰਤ ਦਾ ਇਤਿਹਾਸ ਬਹੁਤ ਹੀ ਮੁਸ਼ਕਲਾਂ ਭਰਾ ਰਿਹਾ ਹੈ ਭਾਰਤ ਨੂੰ ਅਲੱਗ ਅਲੱਗ ਸਮੇਂ 'ਤੇ ਅਲੱਗ ਅਲੱਗ ਅ ਤਰਫ ਤੋਂ ਅ ਅਪ ਮੁਸ਼ ਦੁਸ਼ਮਣਾਂ ਦਾ ਸਾਹਮਣਾ ਕਰਨਾ ਪਿਆ ਭਾਰਤ ਨੇ ਕਾਫੀ ਜ਼ਿਆਦਾ ਗੁਲਾ ਗੁਲਾਮੀ ਸਹੀ ਹੈ ਅਤੇ ਬਹੁਤ ਜ਼ਿਆਦਾ ਆਪਣਾ ਖੂਨ ਦਿੱਤਾ ਹੈ ਅਤੇ ਆਪਣੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੱਜ ਭਾ ਅਗਰ ਆਪਾਂ ਸਵਤੰਤਰ ਭਾਰਤ ਵਿੱਚ ਰਹਿ ਰਹੇ ਹਾਂ ਤਾਂ ਇਹ ਉਹਨਾਂ ਦੀ ਸ਼ਹੀਦਾਂ ਦੀ ਹੀ ਕੁਰਬਾਨੀ ਹੈ ਜਿਸ ਕਰਕੇ ਅੱਜ ਆਪਾਂ ਐਨੀ ਚੰਗੀ ਤਰ੍ਹਾਂ ਰਹਿ ਰਹੇ ਹਾਂ ਭਾਰਤ ਦਾ ਇਤਿਹਾਸ ਕਦੀ ਭਾਰਤ ਨੂੰ ਮੁਸਲਮਾਨਾਂ ਨੇ ਲੁੱਟਿਆ ਉਹਨਾਂ ਨੇ ਆ ਕੇ ਉਹਨਾਂ ਨਾਲ ਬੁਰਾ ਕੀਤਾ ਅਤੇ ਉਹਨਾਂ ਤੋਂ ਜਮ ਜ਼ਮੀਨਾਂ ਖੋਹੀਆਂ ਉਹਨਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਅਤੇ ਸਾਡੀ ਜ਼ਮੀਨ 'ਤੇ ਆ ਕੇ ਸਾਡੇ 'ਤੇ ਹੀ ਰਾਜ ਕੀਤਾ ਅਤੇ ਮੁਸਲਮਾਨਾਂ ਦੇ ਜਾਣ ਤੋਂ ਬਾਅਦ ਅੰਗਰੇਜ਼ ਆ ਗਏ ਅਤੇ ਅੰਗਰੇਜ਼ਾਂ ਨੇ ਸਾਨੂੰ ਪੂਰੇ ਦੋ ਸਾਲ ਤੱਕ ਲੁੱਟਿਆ ਅਤੇ ਸਾਨੂੰ ਸਾਡੀ ਜ਼ਮੀਨ 'ਤੇ ਆ ਕੇ ਸਾਡੇ ਨਾਲ ਬੁਰਾ ਕੀਤਾ ਅਤੇ ਉਹਨਾਂ ਨੂੰ ਉਹ ਉਹਨਾਂ ਤੋਂ ਅਜ਼ਾ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਵਾਸਤੇ ਉਹ ਹ ਭਾਰਤ ਦੇ ਹਰ ਇੱਕ ਅਲੱਗ ਅਲੱਗ ਹਿੱਸੇ ਤੋਂ ਅਲੱਗ ਅਲੱਗ ਲੋਕ ਸਾਹਮਣੇ ਆਏ ਅਤੇ ਉਹਨਾਂ ਨੇ ਮਿਲ ਕੇ ਭਾਰਤ ਨੂੰ ਆਜ਼ਾਦੀ ਦਿਲਵਾਈ ਭਾਰਤ ਨੂੰ ਆਜ਼ਾਦੀ ਦਿਲਵਾਣ ਵਿੱਚ ਸਿਰਫ ਇੱਕ ਜ਼ਿਲ੍ਹੇ ਕਸਬੇ ਜਾਂ ਸਟੇਟ ਦਾ ਹੀ ਮਤਲਬ ਉਹ ਨਹੀਂ ਯੋਗਦਾਨ ਨਹੀਂ ਹੈ ਪੂਰੇ ਭਾਰਤ ਨੇ ਮਿਲ ਕੇ ਆਪਾਂ ਨੂੰ ਆਜ਼ਾਦ ਆਜ਼ਾਦ ਕਰਵਾਉਣ ਵਾਸਤੇ ਗੁਲਾਮੀਆਂ ਅ ਕੁਰਬਾਨੀਆਂ ਦਿੱਤੀਆਂ ਹੈ ਸਾਊਥ ਭਾਰਤ ਤੋਂ ਸਾਊਥ ਇੰਡੀਆ ਤੋਂ ਵੀ ਅਤੇ ਨੌਰਥ ਇੰਡੀਆ ਤੋਂ ਵੀ ਹਰ ਇੱਕ ਜਗ੍ਹਾ ਤੋਂ ਲੋਕ ਸਾਹਮਣੇ ਆਏ ਅਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਆ ਭਾਰਤ ਵਿੱਚ ਬਹੁਤ ਬਹੁਤ ਸਾਰੇ ਇਹ ਇਹੋ ਜਿਹੇ ਨੇਤਾਵਾਂ ਅਤੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਕਾਫੀ ਸਾਰੇ ਇਹੋ ਜਿਹੇ ਸ਼ਹੀਦ ਹਨ ਜਿਨ੍ਹਾਂ ਨੇ ਸ ਆਪ ਸ਼ਹੀਦ ਹੋ ਕੇ ਬਹੁਤ ਛੋਟੀ ਉਮਰ ਵਿੱਚ ਸ਼ਹੀਦ ਹੋ ਕੇ ਸਾਨੂੰ ਆਜ਼ਾਦੀ ਦਿਲਵਾਈ ਭਗਤ ਸਿੰਘ ਵਰਗੇ ਮਹਾਨ ਸ਼ਖਸੀਅਤਾਂ ਨੇ ਅਗਰ ਅੱਜ ਆਪਾਂ ਆਜ਼ਾਦ ਹਾਂ ਤਾਂ ਉਹਨਾਂ ਕਰਕੇ ਹੀ ਹਾਂ ਅਤੇ ਕਾਫੀ ਸਾਰੇ ਨੇਤਾ ਹਨ ਜਿਨ੍ਹਾਂ ਨੇ ਅ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਕਿ ਭਾਰਤ ਨੂੰ ਆਜ਼ਾਦ ਕਰਵਾਇਆ ਜਾ ਸਕੇ ਜਿਵੇਂ ਸੁਭਾਸ਼ ਚੰਦਰ ਬੋਸ ਗਾਂਧੀ ਜੀ ਜਵਾਹਰ ਲਾਲ ਨਹਿਰੂ ਇਹਨਾਂ ਸਭ ਨੇ ਮਿਲ ਕੇ ਭਾਰਤ ਨੂੰ ਆਜ਼ਾਦ ਕਰਵਾਇਆ ਅਤੇ ਆਜ਼ਾਦੀ ਸਾਨੂੰ ਆਜ਼ਾਦੀ ਦਿੱਤੀ ਅਤੇ ਅੱਜ ਅਗਰ ਆਪਾਂ ਸਾਰੇ ਆਜ਼ਾਦ ਹਾਂ ਤਾਂ ਇਸ ਕਰਕੇ ਹੀ ਹਾਂ ਧੰਨਵਾਦ